ਵੈਸੇ ਤਾਂ ਪੰਜਾਬ ਵਿੱਚ ਆਵਾਜਾਈ ਦੇ ਸਾਧਨ ਬਹੁਤ ਸਾਰੇ ਹਨ ਪਰ ਜਿਨ੍ਹਾਂ ਵਿੱਚੋਂ ਮੈਨੂੰ ਗੱਡੀ ਵਿੱਚ ਘੁੰਮਣਾ ਬਹੁਤ ਜ਼ਿਆਦਾ ਪਸੰਦ ਹੈ ਜੇ ਤਾਂ ਅਸੀਂ ਕਿਤੇ ਨੇੜੇ ਤੇੜੇ ਜਾਣਾ ਹੋਵੇ ਫਿਰ ਤਾਂ ਅਸੀਂ ਆਪਣੇ ਮੋਟਰਸਾਈਕਲ 'ਤੇ ਵੀ ਜਾ ਸਕਦੇ ਹਾਂ ਪਰ ਜੇ ਕਿਤੇ ਦੂਰ ਜਾਣਾ ਹੋਵੇ ਤਾਂ ਸਾਨੂੰ ਮੋਟਰਸਾਈਕਲ ਤੋਂ ਇਲਾਵਾ ਗੱਡੀ ਵਿੱਚ ਜਾਣਾ ਚਾਹੀਦਾ ਹੈ ਇੱਕ ਤਾਂ ਇਹਦੇ ਵਿੱਚ ਸੇਫਟੀ ਜ਼ਿਆਦਾ ਵੱਧ ਜਾਂਦੀ ਹੈ ਅਤੇ ਦੂਸਰੀ ਗੱਲ ਅਸੀਂ ਦੋ ਜਾ ਤਿੰਨ ਜਣਿਆ ਤੋਂ ਵੱਧ ਜਣੇ ਜਾ ਸਕਦੇ ਹਾਂ ਅਤੇ ਅਸੀਂ ਫੈਮਲੀ ਟੂਰ ਵੀ ਆਪਣਾ ਇਸ ਰਾਹੀਂ ਪੂਰਾ ਕਰ ਸਕਦੇ ਹਾਂ ਅਤੇ ਪਿਛਲੇ ਹੀ ਸਾਲ ਮੈਂ ਆਪਣੇ ਫੈਮਲੀ ਨਾਲ ਇਹ ਆ ਹਰਿਮੰਦਰ ਸਾਹਿਬ ਦਾ ਟੂਰ ਕੱਢਿਆ ਸੀ ਅਤੇ ਅਸੀਂ ਗੱਡੀ ਵਿੱਚ ਘੁੰਮਣ ਗਏ ਸੀ ਜਿਹਦੇ ਵਿੱਚ ਅਸੀਂ ਬਹੁਤ ਜ਼ਿਆਦਾ ਆਨੰਦ ਮਾਣਿਆ ਠੀਕ ਆ ਅਸੀਂ ਹਰਿਮੰਦਰ ਸਾਹਿਬ ਜੋ ਕਿ ਪੂਰੀ ਦੁਨੀਆ ਵਿੱਚ ਗੋਲਡਨ ਟੈਂਪਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਉੱਥੇ ਵੀ ਘੁੰਮ ਕੇ ਆਏ ਉਸ ਤੋਂ ਬਾਅਦ ਅਸੀਂ ਜਲਿਆਂਵਾਲਾ ਬਾਗ ਵੀ ਘੁੰਮ ਕੇ ਦੇਖਿਆ ਅਤੇ ਬਾਅਦ ਵਿੱਚ ਅਸੀਂ ਸ਼ਾਮ ਦੇ ਟਾਈਮ ਬਾਘਾ ਬਾਡਰ 'ਤੇ ਵੀ ਗਏ ਪਰੇਡ ਦੇਖਣ ਜਿਹਦੇ ਵਿੱਚ ਅਸੀਂ ਦੇਖਿਆ ਕਿ ਸਾਰੇ ਜਣੇ ਬਹੁਤ ਹੀ ਉਤਸ਼ਾਹਿਤ ਸੀ ਅਤੇ ਉੱਥੇ ਆਪਣਾ ਪੂਰਾ ਆਨੰਦ ਮਾਣ ਰਹੇ ਸੀ ਜਿਸ ਕਰਕੇ ਅਸੀਂ ਘੁੰਮ ਕੇ ਆਏ ਤਾਂ ਸਾਨੂੰ ਬਹੁਤ ਹੀ ਵਧੀਆ ਆਨੰਦ ਲੱਗਿਆ ਇਸ ਲਈ ਮੈਂ ਸਾਰਿਆਂ ਨਾਲੋਂ ਜ਼ਿਆਦਾ ਇਸ ਚੀਜ਼ ਨੂੰ ਯਾਤਰਾ ਦੇ ਦੌਰਾਨ ਅਤੇ ਨਾਲ ਹੀ ਨਾਲ ਅਸੀਂ ਕਿੰਨੀਆਂ ਥਾਵਾਂ 'ਤੇ ਖਾਣ ਪੀਣ ਦਾ ਸਮਾਨ ਵੀ ਖਾਧਾ ਠੀਕ ਹੈ ਗੱਡੀ ਵਿੱਚ ਅਸੀਂ ਜਿਸ ਥਾਂ 'ਤੇ ਵੀ ਗਏ ਹਾਂ ਜਿੱਥੇ ਸਾਡਾ ਦਿਲ ਕਰਦਾ ਹੈ ਉੱਥੇ ਅਸੀਂ ਰੋਕ ਸਕਦੇ ਹਾਂ ਅਤੇ ਉੱਥੇ ਅਸੀਂ ਜੋ ਸਾਡਾ ਦਿਲ ਕਰਦਾ ਹੈ ਉਹ ਕਰ ਸਕਦੇ ਹਾਂ ਇਸ ਲਈ ਮੈਂ ਇਸ ਸਾਧਨ ਨੂੰ ਸਾਰਿਆਂ ਨਾਲੋਂ ਜ਼ਿਆਦਾ ਬੜੋਤਰੀ ਦੇਵਾਂਗਾ ਕਿਉਂਕਿ ਇੱਕ ਤਾਂ ਇਹ ਸਸਤਾ ਵੀ ਹੈ ਅਤੇ ਦੂਸਰਾ ਅਸੀਂ ਇਕੱਠੇ ਫੈਮਲੀ ਮੈਂਬਰ ਵੀ ਸਾਰੇ ਜਣੇ ਜਾ ਸਕਦੇ ਹਾਂ